ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਪਣਾ ਫਰਸਟ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੀ ਹਾਂ ਮੈਂ ਫਲਿੱਪਕਾਰਡ ਤੋਂ ਔਡਰ ਕਰਕੇ ਇੱਕ ਪ੍ਰੋਡਕਟ ਮੰਗਵਾਇਆ ਸੀ ਇਹ ਬੈਂਗਲ ਯਾਨੀ ਕਿ ਚੂੜੀਆਂ ਹਨ ਇਹ ਸ਼ਗੁਨ ਕੰਪਨੀ ਵੱਲੋਂ ਤਿਆਰ ਕੀਤੀਆਂ ਗਈਆਂ ਬਹੁਤ ਹੀ ਖੂਬਸੂਰਤ ਚੂੜੀਆਂ ਹਨ ਇਸ ਦੇ ਬਾਰੇ ਜੋ ਵੀ ਜਾਣਕਾਰੀ ਸਾਈਟ ਉੱਤੇ ਦਿੱਤੀ ਗਈ ਸੀ ਉਹ ਬਿਲਕੁਲ ਹੀ ਸਹੀ ਹੈ ਇਹ ਚੂੜੀਆਂ ਦਾ ਰੰਗ ਗੁਲਾਬੀ ਹੈ ਅਤੇ ਇਸ ਉੱਪਰ ਬਹੁਤ ਹੀ ਖੂਬਸੂਰਤ ਮੋਤੀ ਲੱਗੇ ਹੋਏ ਹਨ ਇਹਨਾਂ ਦਾ ਸਾਈਜ਼ ਦੋ ਪੁਆਇੰਟ ਚਾਰ ਹੈ ਅਤੇ ਇਸਦੀ ਕੁਆਂਟਿਟੀ ਵੀ ਮੈਨੂੰ ਬਿਲਕੁਲ ਸਹੀ ਮਿਲੀ ਇਹ ਬਾਰਾਂ ਚੂੜੀਆਂ ਦਾ ਸੈੱਟ ਹੈ ਇਸ ਦੀ ਜਾਣਕਾਰੀ ਜੋ ਵੀ ਸਾਈਟ ਉੱਤੇ ਦਿੱਤੀ ਗਈ ਸੀ ਮੈਨੂੰ ਹੂ ਬ ਹੂ ਉਹ ਹੀ ਪ੍ਰੋਡੈਕਟ ਰਿਸੀਵ ਹੋਇਆ ਇਹ ਪ੍ਰੋਡੈਕਟ ਦੀ ਪੇਮੈਂਟ ਮੈਂ ਔਨਲਾਈਨ ਮੋਡ ਦੇ ਦੁਆਰਾ ਕੀਤੀ ਇਸ ਦੇ ਨਾਲ ਹੀ ਮੈਨੂੰ ਇੱਕ ਕੋਂਪਲੀਮੈਂਟਰੀ ਗਿਫਟ ਵੀ ਮਿਲਿਆ ਗਿਫਟ ਲੈ ਕੇ ਵੀ ਮੈਨੂੰ ਬਹੁਤ ਖੁਸ਼ੀ ਹੋਈ ਔਡਰ ਕਰਨ ਤੋਂ ਤਿੰਨ ਦਿਨ ਬਾਅਦ ਹੀ ਮੈਂ ਇਹ ਪ੍ਰੋਡਕਟ ਰਿਸੀਵ ਕਰ ਲਿਆ ਜੋ ਡਿਲੀਵਰੀ ਬੋਆਏ ਸੀ ਉਸ ਦਾ ਵਰਤਾਵਾ ਵੀ ਬਹੁਤ ਹੀ ਵਧੀਆ ਸੀ ਬਾਕੀ ਜੋ ਵੀ ਜਾਣਕਾਰੀ ਇਸ ਦੇ ਬਾਰੇ ਮੈਂ ਦੇਖੀ ਉਹ ਸਭ ਸਹੀ ਸੀ ਮੇਰਾ ਇਹ ਐਕਸਪੀਰੀਅੰਸ ਬਹੁਤ ਹੀ ਵਧੀਆ ਰਿਹਾ ਮੈਨੂੰ ਨਾ ਹੀ ਔਡਰ ਕਰਨ 'ਚ ਅਤੇ ਨਾ ਹੀ ਪ੍ਰੋਡਕਟ ਨੂੰ ਰਿਸੀਵ ਕਰਨ ਦੇ ਵਿੱਚ ਕੋਈ ਵੀ ਦਿੱਕਤ ਆਈ ਅੱਗੇ ਤੋਂ ਵੀ ਮੈਂ ਇਸ ਸਾਈਟ ਤੋਂ ਸ਼ੋਪਿੰਗ ਕਰਨਾ ਚਾਹਾਂਗੀ ਧੰਨਵਾਦ ਜੀ